ਅੰਮ੍ਰਿਤਸਰ ਸਥਾਨ ਦੀ ਇੱਕ ਮਸ਼ਹੂਰ ਕਲਾ ਜਿਸਨੂੰ ਫੁਲਕਾਰੀ ਕਿਹਾ ਜਾਂਦਾ ਹੈ ਉਹ ਬਹੁਤ ਹੀ ਬਰੀਕੀ ਨਾਲ ਕੀਤੀ ਗਈ ਬਹੁਤ ਹੀ ਰੀਝ ਨਾਲ ਕੀਤੀ ਗਈ ਕਢਾਈ ਹੈ ਜੋ ਕਿ ਕਿਸੇ ਵੀ ਤਰ੍ਹਾਂ ਦੇ ਕੱਪੜੇ 'ਤੇ ਕੀਤੀ ਜਾਂਦੀ ਹੈ ਜ਼ਿਆਦਾਤਰ ਇੱਥੇ ਸਰਦੀ 'ਚ ਲੈਣ ਵਾਲੇ ਸ਼ਾਲ ਜਿਹੜੇ ਹੁੰਦੇ ਹਨ ਉਹਨਾਂ ਉੱਪਰ ਫੁਲਕਾਰੀ ਦੇ ਬੜੇ ਸੋਹਣੇ ਸੋਹਣੇ ਤਸਵੀਰਾਂ ਅਤੇ ਡਿਜ਼ਾਇਨ ਬਣਾਏ ਜਾਂਦੇ ਹਨ